ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਆਪਣੇ ਗੱਡੀ ਟ੍ਰੈਵਲ ਤੋਂ ਬੋਲਦੇ ਹੋਂ ਜੀ ਅਸੀਂ ਗੱਡੀ ਬੁੱਕ ਕਰਾਈ ਤੀ ਜੀ ਤੁਹਾਡੇ ਕੋਲੋਂ ਤੁਹਾਡੇ ਹਾਂਜੀ ਚੰਡੀਗੜ੍ਹ ਘੁੰਮਣ ਵਾਸਤੇ ਜੀ ਡਰਾਈਵਰ ਤਾ ਜੀ ਜਿਹੜਾ ਤੁਹਾਡਾ ਆਪਣਾ ਜੀ ਉਹਨੇ ਨਾ ਮਤਲਬ ਗੱਡੀ 'ਚ ਗੰਦ ਜੀ ਪਾਇਆ ਵਾ ਤਾ ਜੀ ਕਰੋਸਟੀਲ ਦੀ ਕੋਈ ਵੀ ਉਹਨੇ ਵਿੱਚ ਚੀਜ਼ ਨਹੀਂ ਰੱਖੀ ਵੀ ਤੀ ਜਿਵੇਂ ਜੀ ਆਪਣਾ ਮਾਸਕ ਲਾਉਣਾ ਸੇਨਾਟਾਈਜਰ ਜਾਂ ਕੋਈ ਹੱਥ ਧੋਣੇ ਵਾਲੀ ਕੋਈ ਵੀ ਐਟਮ ਮਤਲਬ ਗੱਡੀ ਜਮੀਂ ਵਿੱਚੋਂ ਗੰਦੀ ਜਿਹੀ ਬਣਾਈ ਵੀ ਤੀ ਜੀ ਇਸ ਕਰਕੇ ਤੁਹਾਨੂੰ ਫ਼ੋਨ ਕਰਿਆ ਤਾ ਜੀ ਵੀ ਚਲੋ ਤੁਹਾਨੂੰ ਦੱਸ ਦੇਈਏ ਜੀ ਆਪਣੇ ਡਰਾਈਵਰ ਨੂੰ ਮਾੜਾ ਜਿਹਾ ਸਮਝਾਓ ਜੀ ਹਾਂਜੀ ਚਲੋ ਭਾਅ ਜੀ ਠੀਕ ਹੈ ਜੀ ਓਕੇ